ਖੇਡਾਂ ਵਿੱਚ ਜਾਤ ਪਾਤ ਰੰਗ ਰੂਪ ਔਰਤ ਮਰਦ ਦਾ ਭੇਦ ਭਾਵ ਨਹੀਂ ਹੋਣਾ ਚਾਹੀਦਾ ਖੇਡ ਖੇਡ ਹੀ ਹੁੰਦੀ ਹੈ ਖੇਡ ਖਿਡਾਰੀ ਆਪ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਾ ਹੈ ਖੇਡ ਹਰ ਪੱਧਰ 'ਤੇ ਖੇਡੀ ਜਾਂਦੀ ਹੈ ਔਰਤ ਅਤੇ ਮਰਦ ਦੇ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ ਖੇਡ ਸਮੇਂ ਔਰਤ ਨੂੰ ਮਾੜਾ ਨਾ ਕਿਹਾ ਜਾਵੇ ਕਿਉਂਕਿ ਹੁਣ ਸਮੇਂ ਦੇ ਨਾਲ ਔਰਤ ਵੀ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਇਸ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ ਜੇ ਨਾ ਬਦਲਿਆ ਤਾਂ ਸਾਡੇ ਜ ਆਉਣ ਵਾਲੀਆਂ ਪੀੜੀਆਂ ਦਾ ਵਿਕਾਸ ਨਹੀਂ ਹੋਵੇਗਾ ਧੰਨਵਾਦ